ਪੰਜਾਬ ਵਿੱਚ ਰਾਜ ਸਰਕਾਰ ਕਮਿਊਨਿਟੀ ਦੇ ਅੰਦਰ ਵੱਖ ਵੱਖ ਸਮੂਹ ਸਮੂਹਾਂ ਵਿਚਕਾਰ ਝਗੜਿਆਂ ਅਤੇ ਤ ਤਨਾਅ ਨੂੰ ਹੱਲ ਕਰਨ ਲਈ ਕਈ ਤਰੀ ਤਰੀਕਿਆਂ ਅਤੇ ਸਾਧਨਾਂ ਦਾ ਇਸਤੇਮਾਲ ਕਰਦੀ ਹੈ ਇਹਨਾਂ ਵਿੱਚ ਜ਼ਿਆਦਾਤਰ ਪੁਲਿਸ ਪ੍ਰਸ਼ਾਸਨ ਦਾ ਰੋਲ ਹੁੰਦਾ ਹੈ ਝਗੜਿਆਂ ਅਤੇ ਤਨਾਅ ਨੂੰ ਹੱਲ ਕਰਨ ਲਈ ਪੁਲਿਸ ਮੁੱਖ ਭੂਮਿਕਾ ਨਿਭਾਉਂਦੀ ਹੈ ਉਹ ਸ਼ਕਤੀਸ਼ਾਲੀ ਝਗੜਿਆਂ ਨੂੰ ਨਿਯੰਤਰਨ ਕਰਨ ਲਈ ਤੁਰੰਤ ਕਾਰਵਾਈ ਕਰਦੀ ਹੈ ਜਿਸ ਨਾਲ ਕਿਸੇ ਨੂੰ ਵੀ ਜਾਨ ਮਾਲ ਦੀ ਹਾਨੀ ਨਹੀਂ ਹੁੰਦੀ ਉਹ ਸ਼ਾਂਤੀ ਸ਼ਾਂਤੀ ਮੀਟਿੰਗਾਂ ਕਰਦੀਆਂ ਅਕਸਰ ਥਾਣਾ ਪੱਧਰ 'ਤੇ ਜਾਂ ਜ਼ਿਲ੍ਹਾ ਪੱਧਰ 'ਤੇ ਸ਼ਾਂਤੀ ਮੀਟਿੰਗਾਂ ਕਰਵਾਈਆਂ ਜਾਂਦੀਆਂ ਹਨ ਜਿੱਥੇ ਵੱਖ ਵੱਖ ਸਮੂਹਾਂ ਦੇ ਪ੍ਰਤੀਨਿਧੀ ਬੈਠਦੇ ਹਨ ਅਤੇ ਸਾਂਝਾ ਰਾਹ ਲੱਭਦੇ ਹਨ ਸਮਾਜਿਕ ਸੰਸਥਾਵਾਂ ਅਤੇ ਗੈਰ ਸਰਕਾਰੀ ਸੰਗਠਨ ਜਿਹਨਾਂ ਨੂੰ ਆਪਾਂ ਐਨ ਜੀ ਓਜ ਵੀ ਕਹਿੰਦੇ ਹਨ ਸਮਾਜਿਕ ਸੰਸਥਾਵਾਂ ਅਤੇ ਐਨ ਜੀ ਓਜ ਵੱਲੋਂ ਸਮਾਜਿਕ ਕੈਂਪਾਂ ਦੇ ਰਾਹੀਂ ਲੋਕਾਂ ਨੂੰ ਜਾਗਰਿਤ ਕੀਤ ਜਾਗਰੂਕ ਕੀਤਾ ਜਾਂਦਾ ਹੈ ਕੁਝ ਸੰਸਥਾਵਾਂ ਅਤੇ ਐਨ ਜੀ ਓਜ ਲੋਕਾਂ ਵਿਚਕਾਰ ਸਾਂਝੀ ਸਲਾਹ ਮਸ਼ਵਰਾ ਕਰਵਾਉਣ ਵਿੱਚ ਮਦਦ ਕਰਦੇ ਹਨ ਰਾਜਨੀਤਿਕ ਅਤੇ ਧਾ ਧਾਰਮਿਕ ਨੇਤਾਵਾਂ ਦੀ ਭੂਮਿਕਾ ਰਾਜਨੀਤਿਕ ਨੇਤਾ ਸਮੂਹਾਂ ਦੇ ਵਿਚਕਾਰ ਸੰਪਰਕ ਸਥਾਪਿਤ ਕਰਦੇ ਹਨ ਅਤੇ ਤਨਾਅ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ

ਜੋ ਕਿ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ ਸਾਡੇ ਸਮਾਜ ਵਿੱਚ ਸਮਾਜਿਕ ਨਿਆਂ ਅਤੇ ਸ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਰਾਜ ਸਰਕਾਰ ਵੱਲੋਂ ਸਲਾਹਕਾਰ ਕਮੇਟੀਆਂ ਬਣਾਈਆਂ ਜਾਂਦੀਆਂ ਹਨ ਜੋ ਵਿਵਾਦਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਵਿਧਾਨ ਸਭਾ ਵਿੱਚ ਵੀ ਇਸ ਮੁੱਦੇ ਉੱਤੇ ਚਰਚਾ ਕਰਕੇ ਤਨਾਅ ਨੂੰ ਹੱਲ ਕਰਨ ਦੇ ਲਾ ਰਾਹ ਲੱਭੇ ਜਾਂਦੇ ਹਨ ਕੁਝ ਮਾਮਲਿਆਂ ਵਿੱਚ ਸਮਝੌਤਾ ਅਦਾਲਤ ਦੋਵਾ ਦੁਆਰਾ ਕ ਅਦਾਲਤਾਂ ਦੁਆਰਾ ਮਾਮਲਿਆਂ ਨੂੰ ਸੁਲਝਾਇਆ ਜਾਂਦਾ ਹੈ ਝਗੜਿਆਂ ਅਤੇ ਤਨਾਅ ਨੂੰ ਹੱਲ ਕਰਨ ਲਈ ਰਾਜ ਸਰਕਾਰ ਵੱਲੋਂ ਵਿਧਾਨਕ ਕਾਨੂੰਨੀ ਦਾ ਸਖਤ ਸਖਤੀ ਨਾਲ ਲਾਗੂ ਕੀਤਾ ਜਾ ਉਹਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਂਦਾ ਹੈ ਜਿਸ ਨਾਲ ਤਨਾਅ ਦੇ ਮਾਮਲਿਆਂ ਨੂੰ ਇ ਇਜ਼ੀਲੀ ਆਪਾਂ ਵੀ ਨਿਪਟਾ ਸਕੀਏ ਕਿਸੇ ਨੂੰ ਜਾਨ ਮਾਲ ਦੀ ਹਾਲ ਹਾਨੀ ਨਾ ਹੋ ਸਕੇ ਅਤੇ ਉਹ ਹਮੇਸ਼ਾਂ ਸ਼ ਸ਼ਾਂਤੀ ਦਾ ਰ ਰਾਹ ਲੱਭਦੇ ਹਨ ਪੰਜਾਬ ਵਿੱਚ ਰਾਜ ਸਰਕਾਰ ਵੱਖ ਵੱਖ ਢੰਗਾਂ ਕੀ ਜਿਵੇਂ ਪ੍ਰਸ਼ਾਨ ਪ੍ਰਸ਼ਾਸਨਿਕ ਕਾਰਵਾਈ ਸਮਾਜਿਕ ਸਹਿਯੋਗ ਰਾਜਨੀਤਿਕ ਸੰਸ ਸੰਸਥਾਈ ਤੁਰੰਤ ਅਤੇ ਕਾਨੂੰਨ ਉਪਾਏ ਦੁਆਰਾ ਕਮਿਊਨਿਟੀ ਦੇ ਵਿਚਕਾਰ ਝਗੜਿਆਂ ਅਤੇ ਤਨਾਅ ਨੂੰ ਹੱਲ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਹਨ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ